ਪੰਜਾਬੀ ਭਾਸ਼ਾ ਨੂੰ ਸੁਰੱਖਿਆ ਰੱਖਣ ਲਈ ਅਤੇ ਇਸ ਨੂੰ ਤਾਂ ਕਰਨ ਲਈ ਸਰਕਾਰਾਂ ਕੁਝ ਯਤਨ ਕਰ ਰਹੀਆਂ ਹਨ ਜਿਵੇਂ ਕਿ ਪੰਜਾਬੀ ਵਿਸ਼ੇਸ਼ ਵਿਸ਼ਾ ਲਾਜ਼ਮੀ ਬਣਾਇਆ ਜਾ ਰਿਹਾ ਹੈ ਅਤੇ ਹਰ ਇੱਕ ਪੇਪਰ ਵਿੱਚ ਇਸ ਲਈ ਅੱਗੇ ਤੋਂ ਅੱਗੇ ਨੰਬਰ ਵਧਾਏ ਜਾ ਰਹੇ ਹਨ ਜੋ ਕਿ ਜ਼ਰੂਰੀ ਹਨ ਲੋਕ ਵੱਧ ਤੋਂ ਵੱਧ ਪੰਜਾਬੀ ਬੋਲ ਕੇ ਆਪਣੇ ਬੱਚਿਆਂ ਨੂੰ ਬੋਲਣਾ ਸਿਖਾ ਸਕਦੇ ਹਨ ਇਸ ਤੋਂ ਇਲਾਵਾ ਲੋਕ ਨੂੰ ਆਪਣੇ ਸਰਕਾਰ ਨੂੰ ਆਪਣੀ ਮਾਤ ਭਾਸ਼ਾ ਨੂੰ ਪੀੜੀ ਦਰ ਪੀੜੀ